ਭੰਗੜਾ ਐਰੋਵੀਕਸ ਇਹਨਾਂ ਇਹਨਾਂ ਤਰੀਕਿਆਂ ਨਾਲ ਵਿਅਕਤੀਆਂ ਨੂੰ ਆਪਣੀ ਸੱਭਿਆਚਾਰ ਵਿਰਾਸਤ ਨੂੰ ਅਪਣਾਉਣ ਲਈ ਸ਼ਕਤੀ ਪ੍ਰਦਾਨ ਕਰਦਾ ਹੈ ਕੁਝ ਲੋਕ ਤਣਾਅ ਮੁਕਤ ਹੋਣ ਲਈ ਐਰੋਬਿਕਸ ਭੰਗੜਾ ਕਰ ਕਰਦੇ ਹਨ ਕੁਝ ਲੋਕ ਬਿਮਾਰੀਆਂ ਤੋਂ ਬਚਣ ਲਈ ਐਰੋਬਿਕਸ ਭੰਗੜਾ ਕਰਦੇ ਹਨ ਅਸੀਂ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਦੇ ਕੇ ਇਸ ਦੇ ਵਾਧੇ ਵਿੱਚ ਯੋਗਦਾਨ ਪਾ ਸਕਦੇ ਹਾਂ ਲੋਕਾਂ ਨੂੰ ਆਪਣੀ ਸਿਹਤ ਬਾਰੇ ਦੱਸ ਕੇ ਕਿ ਇਹ ਐਰੋਬਿਕਸ ਭੰਗੜੇ ਰਾਹੀਂ ਕਿਵੇਂ ਚੰਗੀ ਸਿਹਤ ਨੂੰ ਆਪਣਾ ਅਪਣਾ ਸਕਦੇ ਹਾਂ ਅਤੇ ਕਿਸ ਤਰ੍ਹਾਂ ਐਰੋਬਿਕਸ ਭੰਗੜੇ ਰਾਹੀਂ ਰਾਹੀਂ ਆਪਣੀ ਲੰਬੀ ਅਤੇ ਸਿਹਤਮੰਦ ਜੀਵਨ ਜਿਉ ਸਕਦੇ ਹਾਂ